ਮੈਂ ਸਵਿੱਗੀ ਦੀ ਵੈਬਸਾਈਟ 'ਤੇ ਗਿਆ ਅਤੇ ਆਪਣਾ ਲੋਗਿਨ ਜਦੋਂ ਖੋਲ੍ਹਿਆ ਤਾਂ ਦੇਖਿਆ ਕਿ ਕਾਫੀ ਕੂਪਨ ਉਪਲਬਧ ਹਨ ਜਿਵੇਂ ਕਿ ਇੱਕ ਕੂਪਨ ਹੈ ਵਨ ਇੱਕ ਸੌ ਪੰਜਾਹ ਰੁਪਏ ਔਫ ਅਗਰ ਤੁਸੀਂ ਦੋ ਸੌ ਉਨੰਜਾ ਰੁਪਏ ਖਰਚ ਕਰਦੇ ਹੋ ਐਵੇਂ ਇੱਕ ਹੋਰ ਕੂਪਨ ਹੈ ਜੋ ਲਿਖਦਾ ਹੈ ਕਿ ਦਸ ਪ੍ਰਸੈਂਟ ਔਫ ਹੈ ਅਗਰ ਤੁਸੀਂ ਵਨ ਇੱਕ ਸੌ ਪੰਜਾਹ ਰੁਪਏ ਅਗਰ ਤੁਸੀਂ ਖਰਚ ਕਰਦੇ ਹੋ ਐਵੇਂ ਹੀ ਇੱਕ ਹੋਰ ਓ ਓ ਕੂਪਨ ਹੈ ਜਿਵੇਂ ਕਿ ਇੱਕ ਸੌ ਪੰਜਾ ਪਚੱਤਰ ਰੁਪਏ ਔਫ ਹੈ ਅਗਰ ਤੁਸੀਂ ਸਾਢੇ ਤਿੰਨ ਸੌ ਰੁਪਈਆ ਖਰਚ ਕਰਦੇ ਹੋ ਐਂਈ ਤੁਸੀਂ ਇੱਕ ਵੀਹ ਪ੍ਰਸੈਂਟ ਦਾ ਕੂਪਨ ਵੀ ਉਪਲਬਧ ਹੈ ਯਾਨੀ ਕਹਿਣ ਦਾ ਮਤਲਬ ਕਿਆ ਹੈ ਕਿ ਬਹੁਤ ਜ਼ਿਆਦਾ ਕੂਪਨ ਉਪਲਬਧ ਹਨ